ਤਕਨੋਲਜੀ ਅਤੇ ਇੰਟਰਨੈੱਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਨਾਮਾਤਰ ਹੀ ਰਹੀ ਗਈ ਹੈ ਕਿਉਂਕਿ ਆਪਾਂ ਮੀਡੀਆ 'ਤੇ ਜਿਹੜੀਆਂ ਵੀ ਚੀਜ਼ਾਂ ਦੇਖਦੇ ਪੜ੍ਹਦੇ ਸੁਣਦੇ ਜੋ ਵੀ ਕਰਦੇ ਹਾਂ ਉਹ ਸਾਰਾ ਕੁਛ ਇੰਗਲਿਸ਼ ਜਾਂ ਹੋਰ ਭਾਸ਼ਾ ਵਿੱਚ ਹੁੰਦਾ ਹੈ ਅਤੇ ਪੰਜਾਬੀ ਆਪਾਂ ਦਿਨ ਪਰ ਦਿਨ ਭੁੱਲਦੇ ਜਾ ਰਹੇ ਹਾਂ ਆਪਾਂ ਕੋਈ ਵੀ ਚੀਜ਼ ਲੈਣੀ ਹੈ ਜਾਂ ਦੇਣੀ ਹੈ ਕੋਈ ਓਡਰ ਕਰਨਾ ਜਾਂ ਕੋਈ ਵੀ ਚੀਜ਼ ਵੇਖਣੀ ਹੈ ਆਪਾਂ ਇੰਗਲਿਸ਼ ਵਿੱਚ ਹੀ ਟਾਈਪ ਕਰਦੇ ਹਨ ਪੰਜਾਬੀ ਭਾਸ਼ਾ ਨੂੰ ਆਪਾਂ ਵਰਤੋਂ ਬਿਲਕੁਲ ਵੀ ਨਹੀਂ ਕਰਦੇ ਜਿਸ ਨਾਲ ਦਿਨ ਪਰ ਦਿਨ ਪੰਜਾਬੀ ਬੋਲਣੀ ਜਾਂ ਆਪਾਂ ਪੜ੍ਹਣੀ ਘੱਟ ਕਰਦੇ ਜਾ ਰਹੇ ਹਾਂ